ਸਾਡੇ ਕਸਬੇ ਦੇ ਵਿੱਚ ਲਾਈਬ੍ਰੇਰੀ ਹੈਗੀ ਹੈ ਅਤੇ ਮੈਂ ਸ਼ਾਮ ਨੂੰ ਹਰ ਰੋਜ਼ ਉਸ ਲਾਈਬ ਦੇ ਵਿੱਚ ਜਾਂਦਾ ਹਾਂ ਅਤੇ ਮੈਂ ਧਾਰਮਿਕ ਕਿਤਾਬਾਂ ਪੜ੍ਹਨ ਨੂੰ ਜਿਹੜੀ ਹੈਗੀ ਹੈ ਉਹ ਮੇਰੀ ਤਰਜੀਹ ਹੁੰਦੀ ਹੈ ਤਾਂ ਕਿ ਮੈਂ ਆਪਣੇ ਵਿਰਸੇ ਨਾਲ ਜਾਣੂ ਹੋ ਸਕਾਂ ਧੰਨਵਾਦ